ਪੰਜਾਬ ਦੇ ਸਾਡੇ ਸ਼ਹਿਰ ਅੰਮ੍ਰਿਤਸਰ ਵਿੱਚ ਇੱਕ ਸ਼ੋਪਿੰਗ ਮਾਲ ਹੈ ਜਿਸ ਵਿੱਚ ਲੋਕ ਸ਼ੋਪਿੰਗ ਕਰਨ ਦੇ ਨਾਲ ਨਾਲ ਸਿਨਮੇ ਦਾ ਵੀ ਅਨੰਦ ਮਾਣ ਸਕਦੇ ਹਨ ਉਸ ਦਾ ਨਾਮ ਅਲਫ਼ਾ ਵਨ ਹੈ ਜੋ ਕਿ ਅੰਮ੍ਰਿਤਸਰ ਜੀ ਟੀ ਰੋਡ ਦੇ ਮੇਨ 'ਤੇ ਸਥਿਤ ਹੈ ਅੱਜ ਕੱਲ੍ਹ ਇਸ ਨੂੰ ਨੈਕਸਸ ਤੇ ਐਕਸ ਮਾਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਸ ਵਿੱਚ ਥੀਏਟਰ ਬਹੁਤ ਵੱਡਾ ਹੈ ਜਿਸ ਵਿੱਚ ਕਰੀਬ ਪੰਜ ਸੌ ਦੇ ਲਗਭਗ ਇਨਸਾਨ ਇੱਕ ਸਮੇਂ ਵਿੱਚ ਪੰਜਾਬੀ ਫਿਲਮ ਦੇਖ ਕੇ ਦੇਖ ਸਕਦੇ ਹਨ ਲੋਕ ਸ਼ੋਪਿੰਗ ਕਰਨ ਦੇ ਨਾਲ ਨਾਲ ਇਸ ਵਿੱਚ ਥੀਏਟਰ ਦੇਖ ਕੇ ਆਪਣਾ ਮਾਨਸਿਕ ਅਤੇ ਰੋਗ ਘੱਟ ਕਰ ਲੈਂਦੇ ਹਨ ਜੋ ਕਿ ਬਹੁਤ ਹੀ ਆਨੰਦਾਇਕ ਹੁੰਦਾ ਹੈ ਬੱਚਿਆਂ ਲਈ ਵੀ ਕਾਫ਼ੀ ਵੀਕੈਂਡ 'ਤੇ ਅਨੰਦ ਮਾਣਦੇ ਹਨ ਇਸ ਵਿੱਚ ਜੋ ਫ਼ਿਲਮਾਂ ਦੀਆਂ ਟਿਕਟਾਂ ਹਨ ਉਸ ਦਾ ਬਹੁਤ ਹੀ ਘੱਟ ਰੇਟ ਹੈ ਜੋ ਕਿ ਆਮ ਇਨਸਾਨ ਵੀ ਇਸ ਨੂੰ ਆਸਾਨੀ ਦੇ ਨਾਲ ਖਰੀਦ ਸਕਦਾ ਹੈ ਅਤੇ ਆਪਣੇ ਪਰਿਵਾਰ ਨਾਲ ਰਿਸ਼ਤੇਦਾਰਾਂ ਨਾਲ ਆਪਣੇ ਮਿੱਤਰਾਂ ਦੋਸਤਾਂ ਨਾਲ ਥੀਏਟਰ ਦਾ ਅਨੰਦ ਮਾਣ ਸਕਦਾ ਹੈ ਲੋਕਾਂ ਦੀ ਰਿਫਰੈਸ਼ਮੈਂਟ ਲਈ ਥੀਏਟਰ ਵਿੱਚ ਚਾਹ ਬਿਸਕਿੱਟ ਅਤੇ ਬੱਚਿਆਂ ਦੇ ਲਈ ਵੀ ਹੋਰ ਕਾਫ਼ੀ ਖਾਣ ਵਾਲੀਆਂ ਚੀਜ਼ਾਂ ਜੋ ਉਪਲਬਧ ਕਰਵਾਈਆਂ ਜਾਂਦੀਆਂ ਹਨ ਥੀਏਟਰ ਵਿੱਚ ਬਹੁਤ ਹੀ ਜ ਮਤਲਬ ਮਨੋਰੰਜਨ ਦਾ ਸਾਧਨ ਬਹੁਤ ਜ਼ਿਆਦਾ ਹੈ ਅਤੇ ਇਸ ਥੀਏਟਰ ਦੇ ਵਿੱਚ ਇਸ ਮਾਲ ਦੇ ਵਿੱਚ ਸ਼ੋਪਿੰਗ ਮਾਲ ਦੇ ਵਿੱਚ ਲੋਕ ਸ਼ੋਪਿੰਗ ਕਰਨ ਦੇ ਦੌਰਾਨ ਜੋ ਸਭ ਤੋਂ ਵਧੀਆ ਇੱਕ ਚੀਜ਼ ਸਹੂਲਤ ਹੈ ਇਸ ਮਾਲ ਦੀ ਉਹ ਇਹ ਹੈ ਕਿ ਆਪਾਂ ਜਦੋਂ ਜਾਂਦੇ ਹਾਂ ਤਾਂ ਉਸ ਵਿੱਚ ਆਪਾਂ ਨੂੰ ਗੱਡੀਆਂ ਦੀ ਪਾਰਕਿੰਗ ਦਾ ਜਿਹੜਾ ਅੰਡਰਗਰਾਉਂਡ ਉਹਨਾਂ ਨੇ ਮਤਲਬ ਇੱਕ ਜਗ੍ਹਾ ਬਣਾਈ ਹੈ ਉਹਦੇ ਵਿੱਚ ਬਹੁਤ ਹੀ ਵਧੀਆ ਇਹ ਚੀਜ਼ ਲੱਗਦੀ ਹੈ ਕਿ ਆਪਾਂ ਨੂੰ ਆਪਣੇ ਸਾਧਨ ਦੀ ਕੋਈ ਵੀ ਫਿਕਰ ਨਹੀਂ ਰਹਿੰਦੀ ਕਿ ਸਾਡਾ ਕੋਈ ਸਾਧਨ ਜਾਂ ਇੱਧਰ ਉੱਧਰ ਰੋਡ 'ਤੇ ਬਾਹਰ ਖੜ੍ਹਿਆ ਹੈ ਚੋਰੀ ਹੋ ਜੂਗਾ ਜਾਂ ਉਸ ਨੂੰ ਕੋਈ ਨੁਕਸਾਨ ਪੁਚਾ ਦੂਗਾ ਮਤਲਬ ਕਿ ਸੇਫ਼ਲੀ ਆਪਾਂ ਭਾਵੇਂ ਉਸ ਵਿੱਚ ਚਾਰ ਪੰਜ ਛੇ ਘੰਟੇ ਵੀ ਆਪਾਂ ਸ਼ੋਪਿੰਗ ਕਰੀਏ ਜਾਂ ਉਸ ਵਿੱਚ ਕੋਈ ਫਿਲਮ ਵਗੈਰਾ ਜਾਂ ਹੋਰ ਐਂਟਰਟੇਨਮੈਂਟ ਆਪਾਂ ਕਰੀਏ ਤਾਂ ਆਪਾਂ ਨੂੰ ਆਪਣੇ ਸਾਧਨ ਦੀ ਕੋਈ ਵੀ ਮਤਲਬ ਫਿਕਰ ਨਹੀਂ ਹੁੰਦੀ